ਆਮ ਜ਼ੁਕਾਮ ਦੇ ਇਲਾਜ ਲਈ ਸਾਡੇ ਪਿੰਡ ਵਿੱਚ ਬਹੁਤ ਹੀ ਘਰੇਲੂ ਉਪਚਾਰ ਅਪਣਾਏ ਜਾਂਦੇ ਹਨ ਜਿਸ ਤਰ੍ਹਾਂ ਕਿ ਗਰਮ ਪਾਣੀ ਦੇ ਨਾਲ਼ ਭਾਫ਼ ਲੈਣ ਨਾਲ਼ ਬਹੁਤ ਹੀ ਛੇਤੀ ਅਸਰ ਹੁੰਦਾ ਹੈ ਜ਼ੁਕਾਮ ਛੇਤੀ ਠੀਕ ਹੁੰਦਾ ਹੈ ਸਾਨੂੰ ਦਵਾਈਆਂ ਤੋਂ ਛੁਟਕਾਰਾ ਮਿਲਦਾ ਹੈ ਹੋਰ ਕਈ ਉਪਚਾਰ ਜਿੱਦਾਂ ਕਿ ਮੁਲੱਠੀ ਚਬਾਉਣ ਨਾਲ਼ ਉਹਦੇ ਨਾਲ਼ ਵੀ ਗਲੇ ਨੂੰ ਨੱਕ ਨੂੰ ਠੀਕ ਹੋਣ 'ਚ ਮਦਦ ਮਿਲਦੀ ਹੈ ਔਰ ਸ਼ਹਿਦ ਵਿੱਚ ਅਦਰਕ ਦੇ ਕੁਛ ਰਸ ਮਿਲਾਉਣ ਨਾਲ਼ ਉਸਨੂੰ ਲੈਣ ਨਾਲ਼ ਰਾਤ ਨੂੰ ਲੈਣ ਨਾਲ਼ ਸਵੇਰੇ ਬਹੁਤ ਹੀ ਸਵੇਰੇ ਉੱਠ ਕੇ ਦੇਖੋ ਤਾਂ ਬਹੁਤ ਹੀ ਸਾਨੂੰ ਅਸਰ ਹੋਇਆ ਹੁੰਦਾ ਹੈ ਇਸ ਚੀਜ਼ ਦਾ ਬਹੁਤ ਹੀ ਆਰਾਮ ਮਿਲਦਾ ਹੈ ਇਸ ਲਈ ਇਹਨਾਂ ਚੀਜ਼ਾਂ ਨੂੰ ਅਸੀਂ ਆਪਣਾ ਕੇ ਜਲਦੀ ਤੋਂ ਜਲਦੀ ਜ਼ੁਕਾਮ ਤੋਂ ਛੁਟਕਾਰਾ ਪਾ ਸਕਦੇ ਹਾਂ ਔਰ ਦਵਾਈਆਂ ਨੂੰ ਵੀ ਦਵਾਈਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ ਹੋਰ ਵੀ ਕਈ ਤਰ੍ਹਾਂ ਦੇ ਘਰੇਲੂ ਨੁਖਸ ਨੁਸਖੇ ਜੋ ਵੀ ਅਪਣਾਏ ਜਾਂਦੇ ਹਨ ਇਸ ਨੂੰ ਇਸ ਇਸ ਨੂੰ ਅਪਣਾਉਣ ਤੋਂ ਬਾਅਦ ਦਵਾਈਆਂ ਨੂੰ ਬਹੁਤ ਹੀ ਦੂਰ ਕੀਤਾ ਜਾ ਸਕਦਾ ਹੈ ਦਵਾਈਆਂ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦੀਆਂ ਹਨ ਜਿਸ ਤਰ੍ਹਾਂ ਦਰਦ ਲਈ ਦਵਾਈਆਂ ਹੋਰ ਕਈ ਤਰ੍ਹਾਂ ਦੀਆਂ ਦਵਾਈਆਂ ਹੋਈਆਂ ਜਿਹੜੀਆਂ ਕਿ ਸਾਡੇ ਸਰੀਰ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੁੰਦੀਆਂ ਨੇ ਇਸ ਕਰਕੇ ਜਿੰਨਾ ਵੀ ਹੋ ਸਕੇ ਸਾਨੂੰ ਆਪਣੇ ਘਰੇਲੂ ਉਪਚਾਰ ਅਪਣਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ਼ ਚਾਹੇ ਥੋੜ੍ਹੀ ਦੇਰ ਨਾਲ਼ ਅਸਰ ਹੁੰਦਾ ਹੈ ਬਟ ਪਰ ਬਹੁਤ ਹੀ ਵਧੀਆ ਸਾਨੂੰ ਇਸ ਦਾ ਇਸ ਦੇ ਨਾਲ਼ ਸਾਨੂੰ ਆਰਾਮ ਮਿਲਦਾ ਹੈ ਇਸ ਕਰਕੇ ਘਰੇਲੂ ਉਪਚਾਰ ਸਾਡੇ ਪਿੰਡਾਂ ਵਿੱਚ ਜ਼ਿਆਦਾ ਅਪਣਾਏ ਜਾਂਦੇ ਹਨ ਦਵਾਈਆਂ ਨੂੰ ਦਵਾਈਆਂ ਤੋਂ ਅਸੀਂ ਦਵਾਈਆਂ ਨੂੰ ਛੱਡ ਛੱਡ ਅਹ ਦਵਾਈਆਂ ਤੋਂ ਪਰੇ ਹੋ ਸਕਦੇ ਹਾਂ ਦਵਾਈਆਂ ਨੂੰ ਛੱਡ ਸਕਦੇ ਹਾਂ ਇਸੇ ਕਰਕੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਘਰੇਲੂ ਉਪਚਾਰ ਹੀ ਅਪਣਾਉਣੇ ਚਾਹੀਦੇ ਹਨ